ਮੈਂ ਜਦੋਂ ਕਾਲਜ ਪੜ੍ਹਦੀ ਸੀ ਤਾਂ ਸਾਡੇ ਪ੍ਰਿੰਸੀਪਲ ਨੇ ਐਲਾਨ ਕੀਤਾ ਕਿ ਟਰੈਕਿੰਗ ਟਰੈਕਿੰਗ ਕਰਨਾ ਲਈ ਤੁਹਾਨੂੰ ਸਾਰੇ ਬੱਚਿਆਂ ਦਾ ਗਰੁੱਪ ਜਾਵੇਗਾ ਅਤੇ ਮੈਂ ਫਿਰ ਗਰੁੱਪ 'ਚ ਜਾਣਾ ਪਸੰਦ ਕੀਤਾ ਕਿਉਂਕਿ ਗਰੁੱਪ 'ਚ ਜਾਣ ਦਾ ਮੈਨੂੰ ਬਹੁਤ ਹੀ ਫਾਇਦਾ ਹੋਇਆ ਜੇਕਰ ਮੈਂ ਇਕੱਲਿਆਂ ਟਰੈਕਿੰਗ ਕਰਦੀ ਅਤੇ ਮੈਨੂੰ ਕੋਈ ਸਾਥ ਵੀ ਨਹੀਂ ਸੀ ਲੱਭਣਾ ਅਤੇ ਗਰੁੱਪ 'ਚ ਜਾਣ ਦਾ ਇਹ ਫਾਇਦਾ ਹੋਇਆ ਕਿ ਪਤਾ ਵੀ ਨਹੀਂ ਚੱਲਿਆ ਕਦੋਂ ਸਾਡਾ ਸਮਾਂ ਬੀਤ ਬਤੀਤ ਹੋ ਗਿਆ ਅਤੇ ਹੱਸਦਿਆਂ ਖੇਡਦਿਆਂ ਸਾਡਾ ਪੂਰਾ ਸਫਰ ਚੰਗੀ ਤਰ੍ਹਾਂ ਕੰਪਲੀਟ ਕਰ ਦਿੱਤਾ ਅਤੇ ਸਾਨੂੰ ਦੋਸਤਾਂ ਵਿੱਚ ਇੱਕ ਤਾਂ ਇਹ ਵਾਧਾ ਹੋਇਆ ਕਿ ਮੇਰੇ ਪੈਰ 'ਤੇ ਚਲਦੇ ਚਲਦੇ ਸੱਟ ਲੱਗ ਗਈ ਅਤੇ ਮੇਰੇ ਦੋਸਤਾਂ ਨੇ ਮੇਰੀ ਬਹੁਤ ਮਦਦ ਕੀਤੀ ਅਤੇ ਮੈਨੂੰ ਰਸਤੇ ਵਿੱਚ ਕਈ ਤਰ੍ਹਾਂ ਦੀ ਪ੍ਰੋ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ ਜਿਵੇਂ ਕਿ ਮੈਨੂੰ ਦਵਾਈ ਵੀ ਉਹਨਾਂ ਨੇ ਲਿਆ ਕੇ ਦਿੱਤੀ ਅਤੇ ਪੈਸੇ ਵੀ ਉਹਨਾਂ ਨੇ ਖਰਚੇ ਮੇਰੇ ਕੋਲ ਘੱਟ ਪੈਸੇ ਹੋਣ ਦੇ ਕਾਰਨ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਅਸੀਂ ਤੇਰੇ ਨਾਲ ਹਾਂ ਤੂੰ ਕਦੀ ਵੀ ਟੈਸ਼ਨ ਨਹੀਂ ਕਰਨੀ ਆਪਾਂ ਤੇਰੇ ਦੋਸਤ ਹਾਂ ਅਤੇ ਮੈਨੂੰ ਇਹ ਫਰਕ ਲੱਗਿਆ ਵੀ ਜੇਕਰ ਮੈਂ ਇਕੱਲਿਆਂ ਹੁੰਦੀ ਅਤੇ ਮੇਰੇ ਨਾਲ ਕਿਹਨੇ ਹੋਣਾ ਸੀ ਇਸ ਕਰਕੇ ਦੋਸਤਾਂ ਦੇ ਨਾਲ ਸਫਰ ਕਰਨ ਦਾ ਬਹੁਤ ਹੀ ਫਾਇਦਾ ਹੋਇਆ ਗਰੁੱਪ ਵਿੱਚ ਜਾਣ ਲਈ ਬੰਦੇ ਨਾਲ ਕੋਈ ਨਾ ਕੋਈ ਹੋਣਾ ਚਾਹੀਦਾ ਹੈ ਟਾਈਮ ਦਾ ਬੰਦੇ ਨੂੰ ਕੋਈ ਪਤਾ ਨਹੀਂ ਹੁੰਦਾ